ਪੰਜਾਬ ਦੀਆਂ ਕੁਝ ਮਸ਼ਹੂਰ ਹਸਤੀਆਂ ਜਿਵੇਂ ਕਿ ਮਨਮੋਹਨ ਸਿੰਘ ਜੋ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਨ ਮਨਮੋਹਨ ਸਿੰਘ ਦਾ ਜਨਮ ਦੋ ਛੇ ਸਤੰਬਰ ਇੱਕ ਨੌਂ ਤਿੰਨ ਦੋ ਵਿੱਚ ਹੋਇਆ ਇੱਕ ਭਾਰਤੀ ਅੰਤਰਰਾਸ਼ਟਰੀ ਪ੍ਰੋਫੈਸਰ ਸਿਆਸਤਨ ਅਤੇ ਰਾਜ ਨੇਤਾ ਹਨ ਜਿਹਨਾਂ ਨੇ ਦੋ ਜ਼ੀਰੋ ਜ਼ੀਰੋ ਚਾਰ ਤੋਂ ਦੋ ਜ਼ੀਰੋ ਇੱਕ ਚਾਰ ਤੱਕ ਭਾਰਤ ਦੇ ਇੱਕ ਤਿੰਨਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ ਉਹਨਾਂ ਨੇ ਇੱਕ ਨੌਂ ਨੌਂ ਇੱਕ ਤੋਂ ਇੱਕ ਨੌਂ ਨੌਂ ਛੇ ਤੱਕ ਪ੍ਰਧਾਨ ਮੰਤਰੀ ਪੀ ਵੀ ਨਿਰ ਨਿਰਸਿਮਾ ਰਾਓ ਦੇ ਅਧੀਨ ਭਾਰਤ ਦੇ ਦੋ ਦੋ ਵੇ ਮੰਤਰੀ ਵ ਜੋਂ ਕੰਮ ਕੀਤਾ ਉਹਨਾਂ ਨੇ ਇੱਕ ਛੇ ਸਤੰਬਰ ਇੱਕ ਨੌਂ ਅੱਠ ਦੋ ਤੋਂ ਇੱਕ ਚਾਰ ਜਨਵਰੀ ਇੱਕ ਨੌਂ ਅੱਠ ਪੰਜ ਤੱਕ ਭਾਰਤ ਦੀ ਰਿਵਰਜਰ ਬੈਂਕ ਦੇ ਇੱਕ ਪੰਜਵੇਂ ਗਵਰਨਰ ਵਜੋਂ ਸੇਵਾ ਨਿਭਾਈ ਮਨਮੋਹਨ ਸਿੰਘ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ ਜਿਵੇਂ ਕਿ ਇਹ ਮੰਨਿਆ ਜਾਂਦਾ ਹੈ ਇਹ ਜਵਾਹਰ ਲਾਲ ਨਹਿਰੂ ਤੋਂ ਪ ਪਹਿਲੇ ਪ੍ਰਧਾਨ ਮੰਤਰੀ ਹਨ ਜਿਹਨਾਂ ਨੂੰ ਪੂਰੇ ਕਾਰਜ ਕਾਲ ਤੋਂ ਬਾਅਦ ਫਿਰ ਚੁਣਿਆ ਗਿਆ ਬੇਹੱਦ ਘੱਟ ਪਰ ਮਿੱਠਾ ਬੋਲਣ ਵਾਲੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸਾਡੇ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਅੰਦਰ ਸਭ ਤੋਂ ਜ਼ਿਆਦਾ ਸਮਾਨ ਸਮਾਨ ਹਾਸਿਲ ਹੈ ਨਿਊਯੋਕ ਪ੍ਰਤੀਕ ਦੇ ਦੁਨੀਆਂ 'ਚ ਸਭ ਤੋਂ ਜ਼ਿਆਦਾ ਸਮਾਨ ਹਾਸਿਲ ਕਰਨ ਵਾਲੇ ਇੱਕ ਜ਼ੀਰੋ ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ 'ਚ ਡਿਵੈਟਿਡ ਕੈਮ ਕੈਮਰਨ ਨਿਕਲੋਜ ਸਕਰੋਲਜੀਅਨ ਅਤੇ ਵੈਨ ਜੀਓ ਵਰਗੇ ਨੇਤਾਵਾਂ ਨੂੰ ਪਿੱਛੇ ਛੱਡਿਆ ਡਾਕਟਰ ਮਨਮੋਹਨ ਸਿੰਘ ਪਹਿਲੇ ਸਥਾਨ ਉੱਤੇ ਬਿਜੁ ਬਿਰਾਜਨਮਾਨ ਹਨ